ਪੰਜ ਹਜ਼ਾਰ ਚਾਰ ਸੌ

ਹਜ਼ਾਰ ਪੰਜ ਸੌ ਪੰਜਾਹ ਛੇ ਹਜ਼ਾਰ

ਸੌ

ਸੱਠ ਲੱਖ ਚਾਲੀ ਹਜ਼ਾਰ ਛੇ ਸੌ ਪੰਦਰਾਂ ਅੱਠ ਲੱਖ ਬਾਹਠ ਹਜ਼ਾਰ ਨੌ ਸੌ ਪੱਚੀ